ਸਤਿ ਸ਼੍ਰੀ ਅਕਾਲ ਮੇਰਾ ਨਾਮ ਸੁਖਵੀਰ ਸਿੰਘ ਹੈ ਗਰਮੀਆਂ ਦੀਆਂ ਛੁੱਟੀਆਂ ਵਿੱਚ ਮੈਂ ਅਤੇ ਮੇਰੇ ਪਰਿਵਾਰ ਨੇ ਦੋ ਦਿਨ ਲਈ ਘੁੰਮਣ ਜਾਣਾ ਹੈ ਮੇਰੇ ਸਮੇਤ ਮੇਰੇ ਪਰਿਵਾਰ ਵਿੱਚ ਚਾਰ ਮੈਂਬਰ ਹੋਰ ਹਨ ਪਰ ਇੱਕ ਮੈਂਬਰ ਦੇ ਜਾਣ ਬਾਰੇ ਹਜੇ ਕੋਈ ਪੱਕੀ ਸਲਾਹ ਨਹੀਂ ਹੈ ਅਸੀਂ ਘੁੰਮਣ ਲਈ ਜ਼ਿਆਦਾ ਦੂਰ ਨਹੀਂ ਜਾਣਾ ਅੰਮ੍ਰਿਤਸਰ ਹੀ ਘੁੰਮਣਾ ਹੈ ਇਸ ਲਈ ਛੋਟੀਆਂ ਅਤੇ ਮੱਧਮ ਕਾਰ ਦੀਆਂ ਕੈਬਾਂ ਦੀ ਕੀਮਤ ਬਾਰੇ ਦੱਸ ਦੇਵੋ ਚਾਰ ਸਵਾਰੀਆਂ ਵਾਲੀ ਕੈਬ ਦੀ ਅਤੇ ਛੇ ਸਵਾਰੀਆਂ ਵਾਲੀ ਕੈਬ ਦੇ ਵੇਰਵੇ ਕਿਰਪਾ ਕਰਕੇ ਮੈਨੂੰ ਦੱਸੇ ਜਾਣ ਜੇਕਰ ਅਸੀਂ ਪੰਜ ਮੈਂਬਰਾਂ ਨੇ ਜਾਣਾ ਹੋਇਆ ਤਾਂ ਅਸੀਂ ਛੇ ਸਵਾਰੀਆਂ ਵਾਲੀ ਕੈਬ ਲੈ ਲਵਾਂਗੇ ਪਰ ਜੇ ਮੇਰੇ ਪਿਤਾ ਜੀ ਨਾ ਗਏ ਤਾਂ ਚਾਰ ਸਵਾਰੀਆਂ ਵਾਲੀ ਕੈਬ ਹੀ ਠੀਕ ਰਹੇਗੀ ਇਸ ਲਈ ਕਿਰਪਾ ਕਰਕੇ ਮੈਨੂੰ ਕੈਬ ਦੇ ਕਿਰਾਏ ਬਾਰੇ ਦੱਸਿਆ ਜਾਵੇ ਜਿਸ ਵਿੱਚ ਚਾਰ ਅਤੇ ਛੇ ਸਵਾਰੀਆਂ ਬੈਠ ਸਕਣ ਧੰਨਵਾਦ